ਮੈਨੂੰ ਪੇਂਟਿੰਗਸ ਬਣਾਉਣ ਦਾ ਬਹੁਤ ਸ਼ੌਕ ਹੈ ਸਾਡੇ ਆਂਢ ਗੁਆਂਢ ਦੇ ਵਿੱਚ ਵੀ ਸਾਰੇ ਮੇਰੀ ਪੇਂਟਿੰਗਸ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਹਨ ਮੈਂ ਆਪਣੀਆਂ ਪੇਂਟਿੰਗਸ ਨੂੰ ਬਜ਼ਾਰ ਦੇ ਵਿੱਚ ਵੀ ਵੇਚ ਦਿੰਦੀ ਹਾਂ ਜੋ ਮੇਰੀਆਂ ਪੇਂਟਿੰਗਸ ਨੇ ਬਹੁਤ ਵਧੀਆ ਰੇਟ 'ਤੇ ਵਿਕਦੀਆਂ ਹਨ ਮੈਂ ਇਸ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ ਨਵੇਂ ਨਵੇਂ ਬ੍ਰਸ਼ਿਸ਼ ਦਾ ਇਸਤੇਮਾਲ ਕਰਦੀ ਹਾਂ ਨਿਊ ਨਿਊ ਟੈਕਨੀਕਸ ਯੂਸ ਕਰਦੀ ਹਾਂ ਤਾਂ ਜੋ ਮੇਰੀ ਜੋ ਪੇਂਟਿੰਗ ਦੀ ਖੂਬਸੂਰਤੀ ਆ ਉਹ ਹੋਰ ਜ਼ਿਆਦਾ ਉਭਰ ਕੇ ਆਵੇ ਅਤੇ ਮੈਂ ਕਲਰ ਕੋਂਬੀਨੇਸ਼ਨਸ ਦਾ ਵੀ ਹਮੇਸ਼ਾ ਧਿਆਨ ਰੱਖਦੀ ਹਾਂ ਕਿ ਜੋ ਕਲਰ ਕੋਂਬੀਨੇਸ਼ਨਸ ਨੇ ਬਹੁਤ ਜ਼ਿਆਦਾ ਵਧੀਆ ਹੋਣ ਇੱਕ ਦੂਸਰੇ ਦੇ ਨਾਲ ਸੂਟ ਕਰਦੇ ਹੋਣ ਮੈਂ ਹਮੇਸ਼ਾ ਇਸ ਦੇ ਵਿੱਚ ਆਪਣਾ ਹੰਡਰਡ ਪਰਸੈਂਟ ਦੇਣ ਦੀ ਕੋਸ਼ਿਸ਼ ਕਰਦੀ ਹਾਂ ਸਾਡੇ ਆਂਢ ਗੁਆਂਢ ਦੇ ਵਿੱਚ ਕਿਸੇ ਦੀ ਪੇਂਟਿੰਗ ਜ਼ਿਆਦਾ ਵਧੀਆ ਨਹੀਂ ਆ ਤਾਂ ਸਾਰੇ ਮੇਰੇ ਇਸ ਕੰਮ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਹਨ ਅਤੇ ਮੈਨੂੰ ਹਮੇਸ਼ਾ ਪ੍ਰੇਰਿਤ ਕਰਦੇ ਹਨ ਕਿ ਮੈਂ ਕਦੇ ਵੀ ਇਸ ਕੰਮ ਨੂੰ ਨਾ ਛੱਡਾਂ